ਪੰਜਾਬ ਦੇ ਵੱਖ ਵੱਖ ਖੇਤਾ ਵ ਖੇਤਰਾਂ ਵਿੱਚ ਪ੍ਰਚਲਿਤ ਗੱਤਕਾ ਸ਼ੈਲੀਆਂ ਵਿੱਚ ਕਈ ਤਰ੍ਹਾਂ ਦੀਆਂ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ਅੱਡ ਅੱਡ ਤਰ੍ਹਾਂ ਦੀਆਂ ਅੱਡ ਅੱਡ ਤਰ੍ਹਾਂ ਨਾਲ ਗੱਤਕਾ ਖੇਡਿਆ ਜਾਂਦਾ ਹੈ ਗੱਤਕਾ ਸਿੱਖ ਧਰਮ ਦੀ ਫੌਜ ਦਾ ਇੱਕ ਅਨਿੱਖੜਵਾਂ ਅੰਗ ਹੈ ਗੱਤਕਾ ਖੇਡਦੇ ਸਮੇਂ ਕਈ ਸ਼ੈਲੀਆਂ ਅਪਣਾਈਆਂ ਜਾਂਦੀਆਂ ਹਨ ਜਿਵੇਂ ਕਿ ਛੜੀ ਦੇ ਨਾਲ ਵੀ ਖੇਡਿਆ ਜਾਂਦਾ ਹੈ ਗੱਤਕਾ ਕਿਰਪਾਨ ਦੇ ਨਾਲ ਵੀ ਖੇਡਿਆ ਜਾਂਦਾ ਹੈ ਕਿਰਪਾਨ ਅਤੇ ਤਲਵਾਰ 'ਚ ਫ਼ਰਕ ਹੈ ਕਿਰਪਾਨ ਸਿੱਖ ਉਦੋਂ ਵਰਤਦਾ ਹੈ ਜਦੋਂ ਉਹਨੇ ਕਿਸੇ ਦੀ ਰਕਸ਼ਾ ਜਾਂ ਆਪਣੀ ਰਕਸ਼ਾ ਕਰਨੀ ਹੋਵੇ ਗੱਤਕਾ ਖੇਡਦੇ ਸਮੇਂ ਛੜੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਸੋਟੀ ਵਰਤੀ ਜਾਂਦੀ ਹੈ ਇੰਡੀਵਿਜੁਅਲ ਵੀ ਇਹ ਖੇਡਿਆ ਜਾਂਦਾ ਹੈ ਅਤੇ ਟੀਮ ਦੇ ਨਾਲ ਵੀ ਖੇਡਿਆ ਜਾਂਦਾ ਹੈ ਗੱਤਕਾ ਖੇਡਦੇ ਸਮੇਂ ਜਦੋਂ ਛੜੀ ਦਾ ਇਕੱਲਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉਹ ਵੱਖ ਵੱਖ ਤਰ੍ਹਾਂ ਦੇ ਕਰਤੱਵ ਵਿਖਾ ਕੇ ਆਪਣਾ ਬਚਾਅ ਭਲੀਭਾਂਤ ਕਰ ਸਕਦਾ ਹੈ ਅਤੇ ਦੂਜੀ ਦੂਜੀ ਜਿਹੜੀ ਸ਼ੈਲੀ ਹੈ ਗੱਤਕਾ ਖੇਡਣ ਦੀ ਉਹ ਹੈ ਛ ਸੋਟੀ ਦੇ ਨਾਲ ਉਹ ਢਾਲ ਦਾ ਵੀ ਪ੍ਰਯੋਗ ਕਰਦਾ ਹੈ ਉਹ ਜਦੋਂ ਵੀ ਉਹਨੂੰ ਵਾਰ ਲੱਗਣ ਦਾ ਡਰ ਹੁੰਦਾ ਹੈ ਉਹ ਢਾਲ ਦਾ ਪ੍ਰਯੋਗ ਕਰਕੇ ਆਪਣਾ ਆਪ ਬਚਾ ਸਕਦਾ ਹੈ ਜਦੋਂ ਟੀਮ ਵਿੱਚ ਗੱਤਕਾ ਖੇਡਿਆ ਜਾਂਦਾ ਹੈ ਉਦੋਂ ਪਲੇਅਰਾਂ ਦੀ ਗਿਣਤੀ ਚਾਰ ਹੁੰਦੀ ਹੈ ਤਿੰਨ ਖੇਡਦੇ ਹਨ ਅਤੇ ਇੱਕ ਐਕਸਟਰਾ ਪਲੇਅਰ ਹੁੰਦਾ ਹੈ ਉਹ ਐਕਸਟਰਾ ਪਲੇਅਰ ਜਦੋਂ ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਬਹੁਤ ਜ਼ਿਆਦਾ ਇੰਜਰੀ ਹੋ ਜਾਂਦੀ ਹੈ ਜਾਂ ਸੱਟ ਲੱਗ ਜਾਂਦੀ ਹੈ ਉਦੋਂ ਜਦੋਂ ਉਹ ਮਹਿਸੂਸ ਕਰਨ ਵੀ ਨਾ ਹੁਣ ਇਹ ਖਿਡਾਰੀ ਖੇਡ ਨਹੀਂ ਸਕ ਰਿਹਾ ਉਦੋਂ ਚੌਥੇ ਖਿਡਾਰੀ ਦੀ ਚੌਥੇ ਖਿਡਾਰੀ ਨੂੰ ਲਿਆ ਜਾਂਦਾ ਹੈ ਤਾਂ ਕਿ ਖੇਡ ਨੂੰ ਜਾਰੀ ਰੱਖਿਆ ਜਾ ਸਕੇ ਇਸ ਤਰ੍ਹਾਂ ਅੱਡ ਅੱਡ ਸ਼ੈਲੀਆਂ ਹਨ ਜਿਸ ਤਰ੍ਹਾਂ ਨਾਲ ਗ ਗੱਤਕਾ ਖੇਡਿਆ ਜਾਂਦਾ ਹੈ